ਹੈਲੋ ਮੰਮੀ ਸਤਿ ਸ਼੍ਰੀ ਅਕਾਲ ਠੀਕ ਹਾਂ ਜੀ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਮੰਮੀ ਮਿਲ ਗਿਆ ਜੀ ਨਹੀਂ ਫਿਲਹਾਲ ਤਾਂ ਕੋਈ ਦਿੱਕਤ ਨਹੀਂ ਮੰਮੀ ਵਧੀਆ ਰੂਮਮੇਟ ਚੰਗੇ ਮਿਲੇ ਆ ਅਤੇ ਵਧੀਆ ਇਹ ਤਾਂ ਹੈ ਮੰਮੀ ਪਰ ਵੀ ਆਪਾਂ ਨੂੰ ਐਡਜਸਟ ਕਰਨਾ ਪੈਂਦਾ ਮਾਹੌਲ ਦੇ ਹਿਸਾਬ ਨਾਲ ਉਸ ਹਿਸਾਬ ਤੇ ਆਪਾ ਨੂੰ ਰਹਿਣਾ ਪੈਂਦਾ ਹੈ ਨਾ ਮਮੀ ਮੈੱਸ ਬਣੀ ਹੋਈ ਆ ਹੋਸਟਲ ਦੇ ਥੱਲੇ ਬਣੀ ਹੋਈ ਹੈਗੀ ਖਾਣੇ ਵਗੈਰੇ ਦੀ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਹਾਂਜੀ ਖਾਣੇ ਵਾਲੀਆਂ ਆਂਟੀਆਂ ਜੋ ਮੈੱਸ 'ਚ ਲੱਗੀਆਂ ਵਧੀਆ ਸੁਭਾਅ ਦੀਆਂ ਹੈਗੀਆਂ ਜਮਾ ਮਾਂ ਬਾਪ ਵਾਂਗੂ ਟਰੀਟ ਕਰਦੀਆਂ ਦੇਖਦੇ ਹਾਂ ਮੰਮੀ ਜੇ ਤਾਂ ਹੋਇਆ ਇੱਥੇ ਲੋਨਡਰੀ ਵਗੈਰਾ ਦਾ ਸਿਸਟਮ ਤਾਂ ਓਵੇਂ ਕਰ ਲਾਂਗੇ ਅਤੇ ਜੇ ਪਾਣੀ ਵਗੈਰਾ ਦਾ ਸਿਸਟਮ ਚੰਗਾ ਹੋਇਆ ਤਾਂ ਇੱਥੇ ਅਸੀਂ ਵਾਸ਼ ਕਰ ਲਿਆ ਕਰਾਂਗੇ ਨਹੀਂ ਫਿਰ ਦੇਖਾਂਗੇ ਜੇ ਘਰ ਭੇਜਣੇ ਹੋਏ ਤਾਂ ਤੁਹਾਨੂੰ ਦੱਸ ਦਾਂਗੇ ਹਾਂਜੀ ਹਾਂਜੀ ਹਾਂਜੀ ਮੰਮੀ ਕੋਈ ਗੱਲ ਨਹੀਂ ਜੀ ਹਾਂ ਪੰਜਾਬੀ ਥੋੜ੍ਹੀ ਬਹੁਤ ਸਮਝ ਲੈਂਦੀਆਂ ਪਰ ਥੋੜ੍ਹਾ ਇਹ ਹੈ ਵੀ ਬੋਲ ਨਹੀਂ ਸਕਦੀਆਂ ਉਹ ਪਰ ਵੀ ਸਮਝ ਲੈਂਦੀਆਂ ਆ ਅਤੇ ਚਲੋ ਵੀ ਹਿੰਦੀ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਗੱਲ ਸਮਝਾ ਲੈਂਦੇ ਹਾਂ ਅਤੇ ਬਾਕੀ ਕੋਸ਼ਿਸ਼ ਰਹੂਗੀ ਉਹਨਾਂ ਨੂੰ ਪੰਜਾਬੀ ਸਿਖਾਈਏ ਹਾਂਜੀ ਹਾਂਜੀ ਹਾਂਜੀ ਪਾਣੀ ਵਗੈਰਾ ਦਾ ਸਿਸਟਮ ਚੰਗਾ ਹੈਗਾ ਠੀਕ ਆ ਹਾਂਜੀ ਹਜੇ ਤਾਂ ਕੋਈ ਦਿੱਕਤ ਨਹੀਂ ਹੈ ਹਾਂਜੀ ਹਾਂਜੀ ਜੀਅ ਲੱਗ ਗਿਆ ਹਾਂ ਹਾਂਜੀ ਹਾਂਜੀ ਮੰਮੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂ ਠੀਕ ਠੀਕ ਹੈ ਠੀਕ ਹੈ ਮੰਮੀ ਜੀ